ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਪਿਛਲੇ ਸਮੇਂ 'ਚ ਤਾਂ ਜੋ ਵੀ ਦੋ ਹਜ਼ਾਰ ਤੋਂ ਪਹਿਲਾਂ ਸਮਾਂ ਰਿਹਾ ਉਹ ਤਾਂ ਬਜ਼ੁਰਗ ਪੁਰਾਣੀਆਂ ਖਾਦ ਖੁਰਾਕਾਂ ਕਰਕੇ ਜਾਣੇ ਜਾਂਦੇ ਤੇ ਬਜ਼ੁਰਗ ਨੂੰ ਕੋਈ ਕਹਿ ਨਹੀਂ ਸਕਦਾ ਤਾ ਵੀ ਇਹ ਵੀ ਅੱਸੀਆਂ ਨੱਬਿਆਂ ਤੋਂ ਪਰਾਂ ਹੋਣਗੇ ਸਾਰੇ ਹੀ ਕੰਮ ਕਾਰ ਕਰਕੇ ਵਧੀਆ ਚੱਲਦੇ ਤੇ ਅਤੇ ਅੱਜ ਕੱਲ੍ਹ 'ਚ ਜੋ ਅੱਜ ਕੱਲ੍ਹ ਦਾ ਯੁੱਗ ਆ ਉਹ ਮਿਲਾਵਟੀ ਆ ਗਿਆ ਸ ਹਰੇਕ ਚੀਜ਼ 'ਚ ਮਿਲਾਵਟ ਕਣਕ 'ਚ ਸਪ੍ਰੇਆਂ ਕੋਈ ਵੀ ਫ਼ਸਲ ਸਪ੍ਰੇਆਂ ਤੋਂ ਬਗੈਰ ਹੁੰਦੀ ਨਹੀਂ ਇਸ ਕਰਕੇ ਅੱਜ ਕੱਲ੍ਹ ਤਾਂ ਮੈਂ ਕਹਿੰਦਾ ਚਾਲੀ ਸਾਲ ਜਾਂ ਪੰਜਾਹ ਸਾਲ ਨਹੀਂ ਟੱਪਦੇ ਪੰਜਾਹ ਸਾਲ ਨਹੀਂ ਟੱਪਦੇ ਅਤੇ ਬਿਮਾਰੀਆਂ ਸ਼ੁਰੂ ਇੰਨੀਆਂ ਸ਼ੂਗਰ ਗਠੀਆ ਥੈਰਡ ਅਤੇ ਫਿਰ ਉਹ ਮੰਜੇ 'ਤੇ ਪੈ ਜਾਂਦੇ ਆ ਗੋਡੇ ਗੁਡੇ ਅੱਜ ਕੱਲ੍ਹ ਸਾਰਾ ਕੁਝ ਚੱਲਦਾ ਗੋਡੇ ਖ਼ਰਾਬ ਸਾਰਾ ਗ੍ਰੀਸ ਮੁੱਕ ਮੁੱਕ ਗਿਆ ਕਿਸੇ ਦਾ ਅਤੇ ਫਿਰ ਉਹ ਮੰਜੇ 'ਤੇ ਪੈ ਜਾਂਦੇ ਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਉਹਨਾਂ ਦੀ ਇਹੀ ਆ ਵੀ ਉਹਨਾਂ ਦਾ ਖ਼ਾਸ ਧਿਆਨ ਤਾਂ ਇੱਦਾਂ ਹੀ ਰੱਖ ਹੋ ਸਕਦਾ ਵੀ ਉਹਨਾਂ ਦਾ ਵਾਰ ਵਾਰ ਉਹਨਾਂ ਨਾਲ਼ ਵੈਸੇ ਤਾਂ ਹੱਸ ਕੇ ਗੱਲਾਂ ਕਰਨੀਆਂ ਬੰਦੇ ਦਾ ਉੱਦਾਂ ਹੀ ਹਾਲ ਚਾਲ ਪੁੱਛਦੇ ਹੋਏ ਅੱਧਾ ਦਵਾਈ ਯਾਨੀ ਕਿ ਰੋਗ ਖ਼ਤਮ ਹੋ ਜਾਂਦਾ ਅਤੇ ਖ਼ਾਸ ਧਿਆਨ ਤਾਂ ਐਦੀ ਹੀ ਕਿ ਦਵਾਈ ਦੇ ਦਵੂਈ ਦੇ ਕੇ ਜਾਂ ਚੰਗੀ ਖੁਰਾਕ ਚੰਗਾ ਦੁੱਧ ਪਾਣੀ ਰੱਖ ਸਕੀਏ ਫਿਰ ਵਧੀਆ ਧਿਆਨ ਰੱਖ ਸਕਦੇ ਹਾਂ ਜਾਂ ਲੱਤਾਂ ਘੁੱਟ ਸਕੀਏ ਉਹਨਾਂ ਦੀਆਂ